ਮੈਂ ਗੁਰਦਾਸਪੁਰ ਤੋਂ ਹਰਜੀਤ ਕੌਰ ਬੋਲਦੀ ਪਈ ਹਾਂ ਜੀ ਸਤਿ ਸ਼੍ਰੀ ਅਕਾਲ ਅਸੀਂ ਹਰ ਜਗ੍ਹਾ 'ਤੇ ਪੰਜਾਬੀ ਭਾਸ਼ਾ ਹੀ ਦੀ ਵਰਤੋਂ ਕਰਦੇ ਹਾਂ ਜੋ ਵੀ ਕੰਮ ਕਰਨਾ ਹੋਵੇ ਜਾਂ ਬੈਂਕਾਂ 'ਚ ਜਾਣਾ ਹੋਵੇ ਜਾਂ ਡਾਕਖਾਨੇ ਜਾਣਾ ਹੋਵੇ ਜਾਂ ਕਿਤੇ ਵੀ ਕੋਈ ਵੀ ਸਕੂਲਾਂ 'ਚ ਜਾਣਾ ਹੋਏ ਦਫਤਰਾਂ 'ਚ ਅਸੀਂ ਪੰਜਾਬੀ ਭਾਸ਼ਾ ਹੀ ਪੰਜਾਬੀ ਵਿੱਚ ਹੀ ਗੱਲ ਕਰਦੇ ਹਾਂ ਜਿੱਦਾਂ ਅਸੀਂ ਪੰਜਾਬ 'ਚ ਰਹਿੰਦੇ ਹਾਂ ਅਤੇ ਹਰ ਚੀਜ਼ ਅਸੀਂ ਪੰਜਾਬੀ ਦੇ ਵਿੱਚ ਹੀ ਹੀ ਸਾਰੇ ਮਤਲਬ ਕਿ ਗੱਲਬਾਤ ਕਰਦੇ ਹਾਂ ਜਿਹੜੀ ਜਿਹੜੀ ਆਪ ਜੇ ਕੋਈ ਮਤਲਬ ਕਿ ਵਪਾਰ ਜਾਂ ਆਰਥਿਕ ਜਿਹੜੀ ਸਥਿਤੀ ਆ ਉਹ ਵੀ ਅਸੀਂ ਮਤਲਬ ਕਿ ਪੰਜਾਬੀ ਦੇ ਵਿੱਚ ਹੀ ਹਰ ਇੱਕ ਨੂੰ ਹਰ ਇੱਕ ਦੇ ਨਾਲ ਵੀ ਗੱਲ ਕਰਦੇ ਹਾਂ ਵੀ ਸਾਡੀ ਆਰਥਿਕ ਹਾਲਤ ਕਿੱਦਾਂ ਦੀ ਆ ਜਾਂ ਕੀ ਹਿਸਾਬ ਕਿਤਾਬ ਹੈਗਾ ਪੰਜਾਬ ਵਿੱਚ ਹੀ ਰਹਿ ਕੇ ਅਸੀਂ ਜਿੱਥੇ ਕਿਸੇ ਦੇ ਘਰ ਵੀ ਜਾਣਾ ਜਾਂ ਕਿਸੇ ਰਿਸ਼ੇਤੇਦਾਰਾਂ ਕੋਲ ਜਾਣਾ ਹਰ ਜਗ੍ਹਾ ਦੇ ਉੱਤੇ ਹੀ ਪੰਜਾਬੀ ਭਾਸ਼ਾ ਬੋਲਦੇ ਹਾਂ ਜੇ ਕਿਤੇ ਅਸੀਂ ਬਾਹਰ ਪੰਜਾਬ ਤੋਂ ਜਾਣਾ ਹੋਵੇ ਤਾਂ ਸਾਨੂੰ ਉਹਨਾਂ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਸਾਨੂੰ ਮਤਲਬ ਕਿ ਘੱਟ ਹੀ ਸਮਝ ਆਉਂਦੀ ਆ ਜਿਹੜਾ ਪੰਜਾਬ ਆ ਪੰਜਾਬ ਵਿੱਚ ਹਰ ਚੀਜ਼ ਹਰ ਦਫਤਰ ਵਿੱਚ ਸਰਕਾਰੀ ਸਕੂਲਾਂ 'ਚ ਬੈਂਕਾਂ 'ਚ ਸਾਡੇ ਇੱਥੇ ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਆ ਪੰਜਾਬੀ ਭਾਸ਼ਾ ਦੀ ਹੀ ਜ਼ਿਆਦਾ ਵਰਤੋਂ ਇੱਥੇ ਹੁੰਦੀ ਆ ਜਿਹੜਾ ਵਪਾਰ ਆ ਉਹ ਵੀ ਪੰਜਾਬੀ ਵਿੱਚ ਹੀ ਗੱਲਬਾਤ ਕਰਦੇ ਹਾਂ ਜਾਂ ਕਿਤੇ ਵੀ ਜਾਣਾ ਹੋਵੇ ਵਪਾਰੀ ਦਾ ਕੋਈ ਕੰਮ ਕਰਨਾ ਵਪਾਰ ਦਾ ਕਰਨਾ ਤਾਂ ਉਹਨੂੰ ਆਪਣੀ ਜਿਹੜੀ ਸਥਿਤੀ ਦਿਸ ਆਰਥਿਕ ਜਿਹੜੀ ਸਥਿਤੀ ਆ ਉਹ ਉਹਨੂੰ ਉਸ ਤਰ੍ਹਾਂ ਹੀ ਦੱਸੀ ਜਾਂਦੀ ਆ ਅਤੇ ਪੰਜਾਬ ਵਿੱਚ ਜਿੱਦਾਂ ਹੁਣ ਅਸੀਂ ਬੱਚਿਆਂ ਦੇ ਨਾਲ ਕੋਈ ਗੱਲਬਾਤ ਕਰਨੀ ਉਹ ਵੀ ਪੰਜਾਬੀ ਵਿੱਚ ਹੀ ਬੋਲਦੇ ਹਾਂ ਕਿਉਂਕਿ ਅਸੀਂ ਸਾਡੇ ਇੱਥੇ ਜਿਹੜੀ ਸਾਡੀ ਬੋਲੀ ਜਿਹੜੀ ਹੈਗੀ ਆ ਉਹ ਪੰਜਾਬੀ ਹੈਗੀ ਆ ਅਤੇ ਇਸ ਕਰਕੇ ਹਰ ਜਿਹੜਾ ਕੰਮ ਹੈਗਾ ਵਾ ਉਹ ਪੰਜਾਬੀ ਵਿੱਚ ਹੀ ਹੀ ਕਰਦੇ ਹਾਂ ਅਤੇ ਜਿਹੜਾ ਜਿਹੜਾ ਸਾਡਾ ਵਪਾਰ ਦਾ ਕੋਈ ਕੰਮ ਵੀ ਕਰਨਾ ਹੋਵੇ ਉਹ ਵੀ ਅਸੀਂ ਪੰਜਾਬ ਵਿੱਚ ਰਹਿ ਕੇ ਹੀ ਪੰਜਾਬੀ ਕੰਮ ਕਰਦੇ ਹਾਂ ਅਤੇ ਬਾਕੀ ਇਹ ਹੈ ਵੀ ਅਸੀਂ ਸਾਨੂੰ ਆਪਣੀ ਜਿਹੜੀ ਬੋਲੀ ਵਾ ਹੈਗੀ ਆ ਪੰਜਾਬੀ ਬਹੁਤ ਹੀ ਚੰਗੀ ਭਾਸ਼ਾ ਲੱਗਦੀ ਹੈਗੀ ਆ ਅਤੇ